ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਅਰਸ਼ ਬੋਲੋ ਬੇਟਾ ਕਿਸ ਦਿਨ ਫੰਕਸ਼ਨ ਕਿਸ ਤਰ੍ਹਾਂ ਅੱਜ ਫੰਕਸ਼ਨ ਐਤਵਾਰ ਨੂੰ ਕਿੰਨੇ ਕੁ ਵਜੇ ਦਾ ਸ਼ਾਮ ਨੂੰ ਯਾਰ ਛੇ ਸੱਤ ਵਜੇ ਦਾ ਤਾਂ ਯਾਰ ਪੀਕ ਟਾਈਮ ਹੁੰਦਾ ਉਦੋਂ ਤਾਂ ਇੰਨਾ ਟਰੈਫਿਕ ਹੋ ਜਾਂਦਾ ਰਸ਼ ਇੱਥੇ ਅਤੇ ਮੈਂ ਇਧਰੋਂ ਫਿਰੋਜ਼ਪੁਰ ਰੋਡ ਤੋਂ ਆਉਣਾ ਹੁੰਦਾ ਅਤੇ ਮਤਲਬ ਦੋ ਦੋ ਘੰਟੇ ਜਾਮ 'ਚ ਹੀ ਲੱਗ ਜਾਂਦੇ ਨੇ ਅਤੇ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਾਂਗਾ ਪੂਰੀ ਥੋੜ੍ਹਾ ਪਰ ਪਹਿਲਾਂ ਚੱਲ ਪਵਾਂਗੇ ਨਾ ਪਰ ਜੇ ਹੋ ਸਕਦਾ ਤਾਂ ਤੁਸੀਂ ਟਾਈਮ ਪ੍ਰੋਗਰਾਮ ਦਾ ਚੇਂਜ ਹੋ ਸਕਦਾ ਤਾਂ ਬਾਹਲੀ ਵਧੀਆ ਗੱਲ ਆ ਅੱਛਾ ਅੱਛਾ ਆਓ ਫਿਰ ਉਹ ਤੁਸੀਂ ਟਰੈਫਿਕ ਦਾ ਹੁਣ ਮੈਂ ਸਵੇਰੇ ਵੀ ਜਦੋਂ ਕੰਮ 'ਤੇ ਜਾਈਦਾ ਸਵੇਰੇ ਵੀ ਸੈਵਨ ਟੂ ਨਾਈਨ ਉਦੋਂ ਵੀ ਪੀਕ ਹੁੰਦਾ ਪੂਰਾ ਬਹੁਤ ਜ਼ਿਆਦੇ ਟਰੈਫਿਕ ਹੁੰਦਾ ਨਾਲੇ ਮਨੀਜ਼ ਤੁਹਾਡੇ ਵਾਲੇ ਪਾਸੇ ਤਾਂ ਇਹ ਰੋਡ ਦੇ ਉੱਤੇ ਗਿੱਲ ਰੋਡ ਅਤੇ ਤਾਂ ਬਹੁਤ ਟਰੈਫਿਕ ਰਹਿੰਦਾ

ਅੱਛਾ ਹਾਂ ਮੈਨੂੰ ਲੱਗਦਾ ਸਪੀਡ ਲਿਮਿਟ ਵੀ ਇਹਨਾਂ ਨੇ ਕੁਛ ਉਹ ਕਰਤੀ ਆ ਫਿਕਸ ਹੈ ਨਾ ਹਾਂ ਜੇ ਉਹ ਈ ਚਲਾਣ ਵਾਲਾ ਹੋ ਗਿਆ ਸਹੀ ਫਿਰ ਤਾਂ ਇਹਦਾ ਮਤਲਬ ਸੌਖਾ ਹੋਜੂ ਆਉਣਾ ਜਾਣਾ ਅੱਛਾ ਅੱਛਾ ਕੱਲ੍ਹ ਤੋਂ ਕਰਤਾ ਯਾਨੀ ਹੁਣ ਸਪੀਡ ਲਿਮਿਟ ਦੇ ਵਿੱਚ ਗੱਡੀ ਚਲਾਇਆ ਕਰੀਏ ਗਤੀ ਗਤੀ ਯਾਨੀ ਦੀ ਧੀਂ ਮਤਲਬ ਹੌਲੀ ਗਤੀ 'ਤੇ ਚਲਾਇਆ ਕਰੀਏ ਸੀਟ ਬੈਲਟ ਤਾਂ ਚਲੋ ਆਪਾਂ ਸਾਰੇ ਲਾਉਂਦੇ ਹੀ ਆ ਕਈ ਵਾਰੀ ਸਪੀਡ ਦਾ ਹੀ ਵੱਧ ਘੱਟ ਹੋ ਜਾਂਦੀ ਪਤਾ ਨਹੀਂ ਲੱਗਦਾ ਸੀਟ ਬੈਲਟ ਤਾਂ ਸਾਰੀ ਦੁਨੀਆ ਵਰਤਦੀ ਹੋਈ ਹੈ ਨਾ ਹਾਂ ਚਲੋ ਕੋਈ ਗੱਲ ਨਹੀਂ ਜਰੂਰ ਪਹੁੰਚਾਂਗੇ ਪ੍ਰੋਗਰਾਮ 'ਤੇ ਬਸ ਟਰੈਫਿਕ ਦਾ ਹੀ ਹੈ ਜੇ ਜਾਮ ਵਗੈਰਾ ਲੱਗ ਗਿਆ ਤਾਂ ਫਿਰ ਥੋੜ੍ਹਾ ਜਿਹਾ ਲੇਟ ਹੋ ਜਾਵਾਂਗੇ ਕੋਈ ਗੱਲ ਨਹੀਂ ਮਿਲ ਜਾਵਾਂਗੇ ਘਰੇ ਚਾਹ ਪਾਣੀ ਪੀ ਕੇ ਜਾਵਾਂਗੇ

ਓ ਹੋ ਹੋ ਹੋ ਨਹੀਂ ਮੈਂ ਤਾਂ ਇਧਰ ਫਲਾਈ ਓਵਰ ਬਣੇ ਹੋਏ ਨੇ ਜਿਹੜੇ ਪੁਲ ਬਣੇ ਉਹਨਾਂ ਦੇ ਉੱਪਰ ਦੀ ਵੀ ਆਵਾਂਗਾ ਹਾਂ ਹਾਂ ਹਾਂ ਚਲੋ ਹੋਰ ਹਾਂ ਕੋਈ ਗੱਲ ਜ਼ਰੂਰ ਆਉਂ ਥੋੜ੍ਹਾ ਬਹੁਤਾ ਅੱਗੇ ਪਿੱਛੇ ਹੋ ਗਿਆ ਤਾਂ ਅੱਜ ਕੋਈ ਗੱਲ ਨਹੀਂ ਮੈਂ ਪਹੁੰਚ ਜਾਵਾਂਗਾ ਠੀਕ ਠੀਕ ਆ ਜੀ ਠੀਕ ਆ ਜੀ ਓਕੇ ਜੀ ਓਕੇ